ਅਠਾਈ ਨਵੰਬਰ ਉੱਨੀ ਸੌ ਅਠਾਸੀ ਪੰਦਰ੍ਹਾਂ ਫਰਵਰੀ ਉੱਨੀ ਸੌ ਇਕਾਨਵੇਂ ਚੌਦ੍ਹਾਂ ਦਸੰਬਰ ਦੋ ਹਜ਼ਾਰ ਦਸ ਸਤਾਰ੍ਹਾਂ ਜੂਨ ਦੋ ਹਜ਼ਾਰ ਸੋਲ੍ਹਾਂ ਅਠਾਰ੍ਹਾਂ ਫਰਵਰੀ ਦੋ ਹਜ਼ਾਰ ਇੱਕੀ